ਹੈਲੋ ਹਾਂਜੀ ਤੁਸੀਂ ਬਠਿੰਡਾ ਥਾਣੇ 'ਚੋਂ ਬੋਲ ਰਹੇ ਹੋ ਸਰ ਆਪਣੇ ਨਾ ਮ ਬਠਿੰਡਾ ਸ਼ਹਿਰ 'ਚ ਬਹੁਤ ਨਸ਼ੇ ਦੀ ਜ਼ਿਆਦਾ ਉਹ ਹੋ ਰਹੀ ਹੈ ਛੁਆ ਜਿਹੜੇ ਨਸ਼ੇੜੀ ਚਿੱਟੇ ਵਾਲੇ ਉਹ ਨਸ਼ਾ ਚੋਰੀਆਂ ਕਰ ਰਹੇ ਆ ਜਾਂਦੇ ਜਾਂਦੇ ਮੋਟਰਸਾਇਕਲ ਤੋਂ ਮੈਂ ਆਪਣਾ ਪੱਤਰਕਾਰ ਕਰ ਰਿਹਾ ਅਜੀਤ ਹਾਂਜੀ ਅਤੇ ਤੁਸੀਂ ਤਾਂ ਸਰ ਇਹਦੇ ਬਾਰੇ ਤੁਸੀਂ ਕੀ ਬਣਾ ਰਹੇ ਹੋ ਇਹਨਾਂ ਨੂੰ ਹਟਾਉਣ ਵਾਸਤੇ ਜਾਂ ਇਹਨਾਂ ਨੂੰ ਬੰਦ ਕਰਨ ਵਾਸਤੇ ਕੀ ਵੀ ਵਿਉਂਤ ਵਿਧੀ ਹੈ ਤੁਹਾਡੀ

ਅਜੀਤ ਦੀ ਅਤੇ

ਅੱਛਾ ਜੀ ਅੱਛਾ ਜੀ ਤੇ ਹਾਂਜੀ ਹਾਂ ਤੇ ਅੱਛਾ ਜੀ ਹਾਂ ਅਤੇ ਬਸ ਬਸ ਤੁਸੀਂ ਮਾੜਾ ਜਿਹਾ ਹੋਰ ਵੀ ਬ ਅ ਆਪਣੀ ਸਮਾਜ ਸੇਵੀ ਸੰਸਥਾ ਨੂੰ ਵੀ ਤੁਸੀਂ ਜਾਗਰੂਕ ਕਰੋ ਜੀ ਠੀਕ ਠੀਕ ਧਨਵਾਦ